ਪੇਸਟਰੀਜ ਆਰ ਸਮਾਲ ਬੋਨਸ ਮੇਡ ਯੂਜਿੰਗ ਇਜ ਸਟਿਫ ਟੋਪਸ ਨੇਚਿਗ ਵਿਦ ਚੈ ਸਮ ਡਿਸੀਸ ਸਚ ਐਜ ਏ ਪਾਈਥਸ ਐਡ ਮੇਡ ਟੂ ਪੇਸਟਰੀ ਕੇਕ ਇਜ ਦਾ ਕੋਬੋਸੋਫ ਪਲੀਟਲੀ ਕਟੈਂਟਸ ਔਫ ਫੀਲਿੰਗ ਸਵੀਸ ਔਫ ਸੋਰੇ ਇੰਟੀਗ੍ਰੇਟਿਡਸ ਦਾ ਫਾਈਵ ਬੇਸਿਕ ਟਾਈਪ ਓਫ ਪੇਸਟਰੀ ਫੂਡ ਦੈਟ ਕੰਬੀਨੇਸ਼ਨ ਫਰੋਡ ਐਂਡ ਫੈਟ ਐਂਡ ਸ਼ੋਟ ਕਰੋਸ ਪੇਸਟਰੀ ਫੈਲੋ ਪੇਸਟਰੀ ਚੋਕੋ ਪੇਸਟਰੀ ਪਲੈਕੀ ਪਸਟਰੀਅਨ ਪਫ ਪੇਸਟਰੀ ਡੋਜਸ ਐਨ ਆਈਦਰ ਨੋਲੀਮੀਨੇਟਡ ਦੈਨ ਫੈਟ ਇਜ ਕੱਟ ਐਂਡ ਰਬੜ ਇਨਟੂ ਦਾ ਫਲੋਰ ਔਰ ਐਲਸ ਲੈਮੀਨੇਟਰ ਵਟ ਦੈਟ ਇਜ ਰਿਪਲੇਟਲੀ ਫਰੋਡਲੀ ਇਨਟੂ ਦਾ ਡੋਜ ਇਜ ਯੂਜਿੰਗ ਦਾ ਟੈਕਨੀਕ ਕਾਲਜ ਲੈਮੀਨੇਸ਼ਨਸ ਐਨ ਇੰਗਜੈਪਲ ਫੋਰ ਐਨੀਨੇਸ਼ਨ ਪੇਸਟਰੀਜ ਵਰਡ ਇਜ ਪਾਈ ਐਡ ਟੈਟ ਕਰੋਸ ਐਂਡ ਬ੍ਰੀਕੁਟਸ ਐਂਡ ਇੰਗਜਾਪਲ ਔਫ ਲੈਮੀਨੇਸਟ ਪੇਸਟਰੀ ਵੋਟ ਐਗਜੀ ਕਰੋਸਟੀ ਐਂਡ ਡੈਨਿਸ਼ਿਸ਼ ਪਬ ਪੇਸਟਰੀਜ਼